ਹੈਲੋ ਸਤਿ ਸ਼੍ਰੀ ਅਕਾਲ ਸਰ ਹੋ ਕੀ ਹਾਲ ਚਾਲ ਹੈ ਸਰ ਜੀ ਅਸੀਂ ਤੁਹਾਡੇ ਇਲਾਕੇ ਦੇ ਐਮਸੀ ਬੋਲ ਰਹੇ ਹਾਂ ਤੁਹਾਡੇ ਇਲਾਕੇ 'ਚੋਂ ਹੀ ਤੁਸੀਂ ਕਲਾਸ 'ਚੋਂ ਬੋਲ ਰਹੇ ਜੀ ਅਸੀਂ ਵੀ ਸਾਰੀਆਂ ਰੁੱਤਾਂ ਦੇ ਦੇ ਮੌਸਮ ਦੇ ਹਿਸਾਬ ਦੇ ਸਾਰੀਆਂ ਰੁੱਤਾਂ ਦੇ ਫਲ ਵੀ ਲਗਵਾਉਣੇ ਆ ਪੌਦੇ ਲਗਾਉਣੇ ਚਾਹੁੰਦੇ ਹਾਂ ਕੀ ਤੁਸੀਂ ਸਾਨੂੰ ਇਸ ਬਾਰੇ ਕੋਈ ਸੁਜਾਵ ਦੇ ਸਕਦੇ ਹੋ ਵੀ ਅਸੀਂ ਸਾਰੇ ਮੌਸਮਾਂ ਦੇ ਹਿਸਾਬ 'ਤੇ ਲਾਉਣੇ ਚਾਹੁੰਦੇ ਹਰੇਕ ਰੁੱਤਾਂ ਦੇ ਹਾਂਜੀ ਹਾਂਜੀ ਹਾਂਜੀ

ਠੀਕ ਹੈ ਜੀ ਇਹ ਤਾਂ ਬਹੁਤ ਚੰਗੇ ਲੱਗਦੇ ਨੇ ਅਤੇ ਗਰਮੀਆਂ ਲਈ ਕੋਈ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਆ

ਠੀਕ ਹੈ ਜੀ ਠੀਕ ਹੈ ਵੀ ਜੇ ਕੋਈ ਫਲ ਫੂਲ ਦਾ ਵੀ ਬੂਟਾ ਵੀ ਉਹ ਆਪਣੇ ਮੌਸਮ ਦੇ ਹਿਸਾਬ 'ਤੇ

ਹਾਂਜੀ ਹਾਂਜੀ ਠੀਕ ਹੈ ਸਰ

ਠੀਕ ਹੈ ਠੀਕ ਹੈ ਠੀਕ

ਹਾਂਜੀ ਹਾਂਜੀ ਹਾਂਜੀ ਠੀਕ ਹੈ

ਠੀਕ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਸਰ ਜੀ

ਹਾਂਜੀ ਜੇ ਇਹਨਾਂ ਦੀ ਆਪਾਂ ਦੇਖ ਘਰੇ ਲਗਾਉਣੇ ਹੋਣ ਅਤੇ ਜੇ ਇਹਨਾਂ ਦੀ ਦੇਖਭਾਲ ਵਾਸਤੇ ਆਪਾਂ ਚਾਹੀਦੀ ਏ

ਠੀਕ ਹੈ ਸਰ ਠੀਕ ਹੈ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਇਹਦਾ ਮਤਲਬ ਆਪਾਂ ਘਰੇ ਲਗਾ ਸਕਦੇ ਠੀਕ ਹੈ ਸਰ ਜੀ ਮਿਹਰਬਾਨੀ ਹੋਵੇ ਜੀ ਬਹੁਤ ਬਹੁਤ ਤੁਹਾਡੀ